ਜਦੋਂ ਅਸੀਂ ਕੋਈ ਵੀ ਚਿੱਤਰਕਾਰੀ ਕਰਦੇ ਹਾਂ ਤਾਂ ਕੁਛ ਆਮ ਗਲਤੀਆਂ ਹੁੰਦੀਆਂ ਹਨ ਜੋ ਸਾਨੂੰ ਨਹੀਂ ਪਤਾ ਲੱਗਦੀਆਂ ਸ਼ੁਰੂਆਤ ਵਿੱਚ ਕਈ ਵਾਰ ਸਾਨੂੰ ਕੋਈ ਚਿੱਤਰਕਾਰੀ ਕਰਨ ਲੱਗਿਆਂ ਜੋ ਵਿੱਚ ਰੰਗ ਵਰਤੇ ਜਾਂਦੇ ਹਨ ਕਈ ਵਾਰ ਸਾਡੇ ਕੋਲ ਕਈ ਰੰਗ ਪੂਰੇ ਨਹੀਂ ਹੁੰਦੇ ਅਤੇ ਕਈ ਵਾਰ ਨਹੀਂ ਪਤਾ ਲੱਗਦਾ ਸ਼ੁਰੂਆਤ ਵਿੱਚ ਕਿ ਕਿੱਥੋਂ ਸ਼ੁਰੂਆਤ ਕਰਨੀ ਹੈ ਅਤੇ ਕਿੱਥੋਂ ਨਹੀਂ ਅਗਰ ਸ਼ੁਰੂਆਤ ਕਰਨੀ ਹੈ ਤਾਂ ਉਸ ਦੀ ਫਿਨਿਸ਼ਿੰਗ ਕਿਸ ਤਰ੍ਹਾਂ ਆਏਗੀ ਅਗਰ ਇਹ ਫਿਨਿਸ਼ਿੰਗ ਵੀ ਨਾ ਹੋਏ ਤਾਂ ਉਸ ਚਿੱਤਰ ਵਿੱਚ ਬਹੁਤ ਕੁਛ ਉਲਟ ਪੁਲਟ ਹੋ ਜਾਂਦਾ ਹੈ ਜਿਸ ਕਰਕੇ ਚਿੱਤਰ ਖਰਾਬ ਹੋਣ ਦੀ ਸਮੱਸਿਆ ਜ਼ਿਆਦਾ ਵੱਧ ਜਾਂਦੀ ਹੈ ਅਤੇ ਕਈ ਵਾਰ ਕੁਝ ਚੀਜ਼ਾਂ ਆਪਾਂ ਇੱਦਾਂ ਕਰ ਦਿੰਦੇ ਹਾਂ ਕਿ ਆਪਾਂ ਨੂੰ ਖੁਦ ਨੂੰ ਸਮਝ ਨਹੀਂ ਆਉਂਦੀ ਕਿ ਇੱਥੇ ਕਿਹੜਾ ਰੰਗ ਕਿਸ ਤਰ੍ਹਾਂ ਕੰਟਰਾਸਟ ਹੋਵੇਗਾ ਤਾਂ ਜੋ ਇਹ ਥੋੜ੍ਹਾ ਉੱਭਰ ਕੇ ਆਵੇ ਇਹਨਾਂ ਤੋਂ ਬਚਣ ਲਈ ਸਾਨੂੰ ਬਹੁਤ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਹਨ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰਨ ਦੇ ਬਾਅਦ ਸਹੀ ਚਿੱਤਰ ਸਾਡੇ ਕੋਲ ਉਦੋਂ ਹੀ ਬਣਦਾ ਹੈ ਜਦੋਂ ਆਪਾਂ ਕੋਸ਼ਿਸ਼ਾਂ ਨਾ ਕਰਾਂਗੇ ਤਾਂ ਚਿੱਤਰ ਵੀ ਸਹੀ ਤਰੀਕੇ ਨਾਲ ਨਹੀਂ ਬਣੇਗਾ ਅਤੇ ਇਸ ਲਈ ਵੱਧ ਤੋਂ ਵੱਧ ਸਾਨੂੰ ਐਕਸਪੀਰੀਅਸ ਦੀ ਲੋੜ ਹੈ ਵੱਧ ਤੋਂ ਵੱਧ ਅਭਿਆਸ ਕਰਨ ਨਾਲ ਹੀ ਅਸੀਂ ਸਹੀ ਕਲਾਕਾਰ ਬਣ ਸਕਦੇ ਹਾਂ ਅਤੇ ਹੋਰ ਜ਼ਿਆਦਾ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਅਸੀਂ

ਸਾਡੀ ਚਿੱਤਰ ਵਿੱਚ ਕਲਾਕਾਰੀ ਵਿੱਚ ਹੋਰ ਜ਼ਿਆਦਾ ਫਿਨਿਸ਼ਿੰਗ ਆਉਂਦੀ ਹੈ